ਹੈਲੋ ਹਾਂਜੀ ਤੁਸੀਂ ਕੌਣ ਹਾਂਜੀ ਹਾਂਜੀ ਅੱਛਾ ਠੀਕ ਹੈ ਮੈਨੂੰ ਆਈ ਸੀ ਉਹਦੀ ਕੌਲ ਹਰਸ਼ੀਤਾ ਦੀ ਠੀਕ ਹੈ ਠੀਕ ਹੈ ਦੇਖੋ ਹਾਂਜੀ ਦੇਖੋ ਮੌਸਮ ਤਾਂ ਹੁਣ ਹਰ ਪਾਸੇ ਗਰਮੀ ਹੈ ਗਰਮੀ ਦਿਨ ਬ ਦਿਨ ਜਿਵੇਂ ਵਧਦੀ ਜਾ ਰਹੀ ਹੈ ਟੈਂਪਰੇਚਰ ਲਗਾਤਾਰ ਆਪਣਾ ਵੀ ਪੰਤਾਲੀ ਪੰ ਪੰਜਾਹ ਦੇ ਨੇੜੇ ਪਹੁੰਚਣ ਵਾਲਾ ਇੱਥੇ ਵੀ ਗਰਮੀ ਤਾਂ ਉਵੇਂ ਹੀ ਹੈਗੀ ਹੈ ਅਤੇ ਰਹੀ ਗੱਲ ਜਿਵੇਂ ਹੋਸਟਲ ਦੀ ਵਗੈਰਾ ਆਪਾਂ ਗੱਲ ਕਰੀਏ ਹੋਸਟਲ 'ਚ ਜਿਵੇਂ ਪੱਖੇ ਹੀ ਦੇਣਗੇ ਇਹ ਕੂਲਰ ਵਗੈਰਾ ਜਾਂ ਏ ਸੀ ਵਗੈਰਾ ਆਪਣੇ ਇੱਥੇ ਨਹੀਂ ਮਿਲਦੇ ਗੇ ਅਤੇ ਕੂਲਰ ਜੇ ਅਗਰ ਆਪਾਂ ਲੈਣਾ ਹੁੰਦਾ ਤਾਂ ਉਹਦੇ ਮਤਲਬ ਆਪਾਂ ਨੂੰ ਐਕਸਟਰਾ ਚਾਰਜਸ ਪੇਅ ਕਰਨੇ ਹੁੰਦੇ ਜਿਵੇਂ ਕਿ ਸੱਤ ਅੱਠ ਸੌ ਰੁਪਇਆ ਮਹੀਨਾ ਆਪਾਂ ਨੂੰ ਗਰਮੀ ਗਰਮੀ ਜਿਵੇਂ ਆਪਾਂ ਕੂਲਰ ਚਲਾਉਣਾ ਤਾਂ ਇੱਕ ਮਹੀਨੇ ਦੇ ਆਪਾਂ ਨੂੰ ਅੱਠ ਸੌ ਰੁਪਇਆ ਵੱਧ ਭਰਨਾ ਪੈਂਦਾ ਔਨਲਾਈਨ ਅਤੇ ਬਾਕੀ ਜਿਵੇਂ ਕਿ ਨਾ ਨਾ ਕੂਲਰ ਨਹੀਂ ਇੱਥੇ ਤਾਂ ਸਿਰਫ ਪੱਖੇ ਹੀ ਹੈ ਪੱਖੇ ਨਾਲ ਹੀ ਮਤਲਬ ਕਰਨਾ ਪੈਂਦਾ ਬਸ ਇੱਕ ਲਾਈਬ੍ਰੇਰੀ 'ਚ ਆਪਾਂ ਨੂੰ ਜ਼ਰੂਰ ਏ ਸੀ ਮਿਲਦੇ ਹੈ ਏ ਸੀ ਵਿੱਚ ਵੀ ਬੈਠੇ ਹੋ ਲਾਈਬ੍ਰੇਰੀ 'ਚ ਨੌ ਤੋਂ ਪੰਜ ਲਾਈਬ੍ਰੇਰੀ ਖੁੱਲ੍ਹੀ ਰਹਿੰਦੀ ਹੈ ਉੱਥੇ ਬੈਠ ਕੇ ਆਪਾਂ ਪੜ੍ਹ ਲਉ ਜਿਵੇਂ ਮਰਜ਼ੀ ਆਪਦਾ ਨੌ ਤੋਂ ਪੰਜ ਆਪਾਂ ਕਰ ਸਕਦੇ ਹਾਂ ਉੱਥੇ ਤਾਂ ਠੀਕ ਹੈ ਬਾਕੀ ਤਾਂ ਨਹੀਂ ਨਹੀਂ ਫੀਸ ਦੇ ਵਿੱਚ ਹੀ ਆ ਉਹਦਾ ਕੋਈ ਐਕਸਟਰਾ ਪੈਸੇ ਨਹੀਂ ਲੱਗਦੇ ਉਹ ਤਾਂ ਫੀਸ ਦੇ ਵਿੱਚ ਹੀ ਹੈ ਹਾਂਜੀ ਬਸ ਉਹ ਜਿਹੜਾ ਮਤਲਬ ਅੱਠ ਸੌ ਰੁਪਇਆ ਮਹੀਨਾ ਲੱਗੇਗਾ ਅਤੇ ਉਹ ਆਪਾਂ ਨੂੰ ਬਸ ਇੱਕ ਐਪਲੀਕੇਸ਼ਨ ਲਿਖ ਕੇ ਦੇਣੀ ਪੈਂਦੀ ਹੈ ਵੀ ਕੂਲਰ ਆਪਾਂ ਲਗਾਉਣਾ ਅਤੇ ਉਸ ਕਰਕੇ ਸਾਨੂੰ ਪਰਮਿਸ਼ਨ ਦਿੱਤੀ ਜਾਵੇ ਅਤੇ ਬਸ ਇਹਦੇ ਕਰਕੇ ਹੋਰ ਤਾਂ ਕੁਛ ਨਹੀਂ ਜ਼ਿਆਦਾ ਨਹੀਂ ਜ ਜਨਰੇਟਰ ਹੈਗੇ ਹੈ ਐਵੇਂ ਤਾਂ ਲਾਈਟ ਤਾਂ ਨਹੀਂ ਜਾਂਦੀ ਗੀ ਔਰ ਸਾਰੇ ਹੋਸਟਲ ਦੀ ਲਾਈਟ ਹੁਣ ਫੇਰ ਬੱਚੇ ਪੜ੍ਹਨਗੇ ਕਿਵੇਂ ਸਾਰਿਆਂ ਨੇ ਲਾਈਟ ਤਾਂ ਨਹੀਂ ਜਾਂਦੀ ਬਾਕੀ ਸਾਰੇ ਜਨਰੇਟਰ ਵਗੈਰਾ ਹੁੰਦਾ ਬਾਕੀ ਹਾਂ ਗਰਮੀ ਦਾ ਥੋੜ੍ਹਾ ਜਿਹਾ ਹੈ ਵੀ ਚੱਲ ਕੂਲਰ ਲੈ ਲਵੇ ਬੰਦਾ ਆਪਦਾ ਹਾਂਜੀ ਬਿਲਕੁਲ ਇਹ ਤਾਂ ਹੈ ਵੀ ਗਰਮੀ ਵੀ ਸਹਾਰਨੀ ਔਖੀ ਹੋਊਗੀ ਲਗਾਤਾਰ ਗਰਮੀ ਵੱਧਦੀ ਵੀ ਬਹੁਤ ਜਾ ਰਹੀ ਹੈ

ਹੋਰ ਕੀ ਹਾਂ ਹਾਂ ਹਾਂ ਜ਼ਰੂਰ ਤੁਸੀਂ ਜਦੋਂ ਮਰਜ਼ੀ ਫੋਨ ਕਰਿਓ ਠੀਕ ਠੀਕ ਕੋਈ ਗੱਲ